ਦ ਫੂਡ ਆਈਟਮ ਨੇਮਜ਼ ਵਾਜ ਹਟੋ ਮੂੰਗੀ ਕਾਲੇ ਚਨੀ ਵਾਈਟ ਚਨੇ ਪਨੀਰ ਪੀਜ਼ਾ ਬਰਗਰ ਦਾਲ ਮੂੰਗੀ ਪੇਠਾ ਨੂਡਲਜ਼ ਪਾਸਤਾ ਐਸਕਲਾਮੇਟਰੀ ਸਾਈਨ